ਭਾਸ਼ਾ ਭਾਸ਼ਾ ਇੱਕ ਸੰਚਾਰ ਦਾ ਸਾਧਨ ਹੈ ਜੋ ਅਸੀਂ ਇੱਕ ਤੋਂ ਇੱਕ ਇਨਸਾਨ ਤੋਂ ਬਹੁਤ ਇਨਸਾਨਾਂ ਤੱਕ ਕਰਦੇ ਹਾਂ ਭਾਸ਼ਾ ਕਿਸੇ ਚੀਜ਼ ਨੂੰ ਆਪਣੀ ਭਾਵਨਾਵਾਂ ਨੂੰ ਕਿਸੇ ਅੱਗੇ ਪੇਸ਼ ਕਰਨ ਲਈ ਇੱਕ ਸਾਧਨ ਹੈ ਪ੍ਰੰਤੂ ਮਨੁੱਖ ਹੈ ਜੋ ਉਹ ਤਾਂ ਭਾਸ਼ਾ ਬੋਲ ਸਕਦਾ ਹੈ ਕਈ ਜਾਨਵਰ ਐਸੇ ਨੇ ਉਹ ਭਾਸ਼ਾ ਬੋਲ ਤਾਂ ਸਕਦੇ ਨੇ ਪਰ ਉਹ ਮਨੁੱਖ ਤਰ੍ਹਾਂ ਨਹੀਂ ਬੋਲ ਸਕਦੇ ਮਨੁੱਖ ਦੀ ਆਪਣੀ ਇੱਕ ਭਾਸ਼ਾ ਹੈ ਪਰ ਮਨੁੱਖ ਜਾਨਵਰਾਂ ਨਾਲ ਪਸ਼ੂਆਂ ਨਾਲ ਜਾਂ ਹੋਰਾਂ ਨਾਲ ਜੋ ਬੋਲ ਨਹੀਂ ਸਕਦੇ ਉਹਨਾਂ ਨਾਲ ਸੰਚਾਰ ਕਰਨ ਦੇ ਅਲੱਗ ਅਲੱਗ ਤਰੀਕੇ ਨੇ ਜਿਵੇਂ ਕਿ ਹੁਣ ਪਸ਼ੂਆਂ ਨੂੰ ਪਾਣੀ ਪਿਲਾਉਣਾ ਉਹਨਾਂ ਲਈ ਅਲੱਗ ਅਲੱਗ ਤਰੀਕੇ ਨੇ ਜਿਵੇਂ ਪੰਜਾਬੀ ਛੀ ਛੀ ਕਰਕੇ ਪਸ਼ੂਆਂ ਨੂੰ ਪਾਣੀ ਪਿਲਾ ਦਿੰਦੇ ਨੇ ਜਾਨਵਰਾਂ ਨਾਲ ਤੋਤੇ ਨੂੰ ਭਾ ਭਾਸ਼ਾ ਸਿਖਾਈ ਜਾ ਸਕਦੀ ਹੈ ਮਨੁੱਖੀ ਭਾਸ਼ਾ ਤੋਤੇ ਨੂੰ ਸਿਖਾਈ ਜਾ ਸਕਦੀ ਹੈ

ਗੈਰ ਭਾਸ਼ਾਈ ਜਿਵੇਂ ਕਿ ਕੋਈ ਮਨੁੱਖ ਹੈ ਜੋ ਪੰਜਾਬ ਨਾਲ ਰਿਲੇਟਡ ਨਹੀਂ ਹੈ ਉਹਨਾਂ ਨਾਲ ਭਾਸ਼ਾ ਦਾ ਸੰਚਾਰ ਦਾ ਸਾਧਨ ਹੈ ਜੋ ਉਹ ਵੀ ਕੀਤਾ ਜਾ ਸਕਦਾ ਹੈ ਜਿਵੇਂ ਕਿ ਇਸ਼ਾਰਿਆਂ ਨਾਲ ਜਾਂ ਅੱਜ ਕੱਲ੍ਹ ਤਕਨੀਕ ਹੀ ਐਸੀ ਆ ਚੁੱਕੀ ਹੈ ਕਿ ਭਾਸ਼ਾ ਨੂੰ ਸਮਝਾਉਣਾ ਸੌਖਾ ਕਰ ਦਿੱਤਾ ਗਿਆ ਹੈ